ਅੱਜ ਕੱਲ੍ਹ ਬਿਜਲੀ ਬਿਨਾ ਜੀਵਨ ਅਧੂਰਾ ਹੈ ਜਿੱਥੇ ਰੋਜ਼ਾਨਾ ਜ਼ਿੰਦਗੀ ਵਿੱਚ ਬਿਜਲੀ ਦੇ ਬਹੁਤ ਲਾਭ ਹਨ ਉੱਥੇ ਹੀ ਇਸ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਬਿਜਲੀ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ ਥੋੜ੍ਹੀ ਕੀਤੀ ਅਣਗਹਿਲੀ ਕਾਰਨ ਕਈ ਵਾਰ ਬੰਦਾ ਆਪਣੀ ਜ਼ਿੰਦਗੀ ਗਵਾ ਬੈਠਦਾ ਹੈ ਕਿਉਂਕਿ ਮਨੁੱਖ ਇੱਕ ਸੁਚਾਲਕ ਪ੍ਰਾਣੀ ਹੈ ਇਸ ਦੇ ਸਰੀਰ ਵਿੱਚੋਂ ਬਿਜਲੀ ਲੰਘ ਸਕਦੀ ਹੈ ਇਸ ਕਰਕੇ ਜਦੋਂ ਵੀ ਬਿਜਲੀ ਦਾ ਕੋਈ ਕੰਮ ਕਰਨਾ ਹੈ ਅਸੀਂ ਘਰਾਂ ਵਿੱਚ ਕਰਨਾ ਹੈ ਫੈਕਟਰੀਆਂ ਵਿੱਚ ਕਰਨਾ ਹੈ ਤਾਂ ਅਸੀਂ ਆਪਣੇ ਆਪ ਨੂੰ ਧਰਤੀ ਦੇ ਸਿੱਧੇ ਸੰਪਰਕ ਤੋਂ ਬਚਣਾ ਬਹੁਤ ਜ਼ਰੂਰੀ ਹੈ ਸਾਡੇ ਘਰਾਂ ਅਤੇ ਫੈਕਟਰੀਆਂ ਨੂੰ ਅਰਥ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਗੈਰ ਅਰਥਿੰਗ ਦੇ ਬਿਜਲੀ ਲੱਗਣ ਦੇ ਜ਼ਿਆਦਾ ਆਪਣਾ ਕਾਰਨ ਹੋ ਹੋ ਸਕਦੇ ਹਨ ਜ਼ਿਆਦਾ ਚਾਂਸ ਹੋ ਸਕਦਾ ਹੈ ਕਿਉਂਕਿ ਬਿਜਲੀ ਦਾ ਝਟਕਾ ਮਨੁੱਖ ਦੇ ਸਭ ਤੋਂ ਵੱਧ ਦਿਲ ਨੂੰ ਪ੍ਰਭਾਵਿਤ ਕਰਦਾ ਹੈ ਬਿਜਲੀ ਬਹੁਤ ਦੇਰੀ ਜੋ ਅਨਪੜ੍ਹ ਜਾਂ ਜਿਨ੍ਹਾਂ ਨੂੰ ਨਹੀਂ ਆਪਣਾ ਪਤਾ ਹੁੰਦਾ ਉਹ ਆਪਦੀ ਖੇਤਾਂ 'ਚ ਕੰਮ ਕਰਦੇ ਆਪਦੀ ਜਾਨ ਗਵਾ ਬੈਠਦੇ ਹਨ ਕਈ ਵਾਰੀ ਅਸੀਂ ਅਕਸਰ ਦੇਖਦੇ ਹਾਂ ਕਿ ਕੋਈ ਮਜ਼ਦੂਰ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਹਨ ਜਾਂ ਕੋਈ ਬੋਰ ਕਰ ਰਹੇ ਹਨ ਉਹ ਕੀ ਕਰਦੇ ਹਨ ਸਰੀਆ ਲੋਹੇ ਦਾ ਸਰੀਆ ਜੋ ਹੈ ਉਹ ਉੱਪਰ ਜਾ ਲੰਘ ਰਹੀਆਂ ਹਾਈ ਟੈਂਸ਼ਨ ਤਾਰਾਂ ਦੇ ਨਾਲ ਖਹਿ ਜਾਂਦਾ ਹੈ ਅਤੇ ਉਹਨਾਂ ਦੇ ਪੈਰ ਵੀ ਨੰਗੇ ਹੁੰਦੇ ਹਨ ਉਹ ਪੈਰ ਨੰਗੇ ਹੋਣ ਕਰਕੇ ਉਹਨਾਂ ਦਾ ਜਿਹੜਾ ਸਿੱਧਾ ਸੰਪਰਕ ਧਰਤੀ ਨਾਲ ਹੋ ਜਾਂਦਾ ਹੈ ਪੋਜੀਟਿਵ ਜਿਹੜਾ ਹੈ ਚਾਰਜ ਉਹ ਧਰ ਆਪਣਾ ਉੱਤੋਂ ਲੈ ਲੈਂਦੇ ਹਨ ਅਤੇ ਨੈਗੇਟਿਵ ਉਹ ਅਰਥ ਜਿਹੜਾ ਹੈਗਾ ਉਹ ਧਰਤੀ ਤੋਂ ਲੈ ਲੈਂਦੇ ਹਨ ਇਸ ਕਰਕੇ ਇਹ ਉਹਨਾਂ ਦੀ ਮੌਤ ਦਾ ਸਬੱਬ ਬਣ ਜਾਂਦਾ ਹੈ ਇਸ ਦੀ ਵਰਤੋਂ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ